ਸਾਡਾ ਪੰਜਾਬ ਜਿੱਥੇ ਆਪਣੇ ਇਤਿਹਾਸ ਵਾਸਤੇ ਮਸ਼ਹੂਰ ਹੈ ਉੱਥੇ ਇਹ ਆਪਣੇ ਖਾਣ ਪਾਣ ਵਾਸਤੇ ਵੀ ਬਹੁਤ ਮਸ਼ਹੂਰ ਹੈ ਸਭ ਤੋਂ ਪਸੰਦ ਆਉਣ ਵਾਲੀ ਚੀਜ਼ ਜਿਹੜੀ ਪੰਜਾਬ ਵਿੱਚ ਕਿ ਹਰ ਸਟੇਟ ਔਰ ਬਾਹਰੋਂ ਵੀ ਲੋਕ ਸ ਨੂੰ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਇੱਥੋਂ ਦੀ ਸਭ ਤੋਂ ਮਸ਼ਹੂਰ ਡਿਸ਼ ਕਹਿ ਲਓ ਖਾਣਾ ਹੈ ਜੋ ਕਿ ਲੋਕ ਦੂਰੋਂ ਦੂਰੋਂ ਖਾਣ ਵਾਸਤੇ ਮਤਲਬ ਉਸਦੇ ਸਵਾਦ ਨੂੰ ਖਿੱਚੇ ਚਲੇ ਆਉਂਦੇ ਹਨ ਉਹ ਜੋ ਚੀਜ਼ ਹੈ ਉਹ ਸਰ੍ਹੋਂ ਦੇ ਸਾਗ ਅਤੇ ਮੱਕੀ ਦੀ ਰੋਟੀ ਮੱਖਣ ਦਹੀਂ ਲੱਸੀ ਨਾਲ ਬਹੁਤ ਹੀ ਵਧੀਆ ਲੱਗਦਾ ਬਹੁਤ ਲੋਕ ਬੜੇ ਸ਼ੌਂਕ ਨਾਲ ਇਸਨੂੰ ਖਾਂਦੇ ਹਨ ਅਤੇ ਅੰਮ੍ਰਿਤਸਰ ਜਦ ਵੀ ਜਾਂਦੇ ਹਨ ਉੱਥੋਂ ਦੀ ਫਿਸ਼ ਛੋਲੇ ਭਟੂਰੇ ਅਤੇ ਹੋਰ ਵੀ ਕਈ ਚੀਜ਼ਾਂ ਨੇ ਜਿੱਦਾਂ ਕਿ ਮਿੱਸੀ ਰੋਟੀ ਹੋਈ ਅਤੇ ਹੋਰ ਆਪਾਂ ਨੂੰ ਮਤ ਖਾਣ ਦੇ ਜਿੰਨੇ ਪੰਜਾਬੀ ਸ਼ੌਕੀਨ ਹੈ ਇਹ ਸਭ ਤੋਂ ਮਸ਼ਹੂਰ ਚੀਜ਼ ਵਾਸਤੇ ਪੰਜਾਬੀ ਸਭ ਤੋਂ ਜ਼ਿਆਦਾ ਤਾਂ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਵਾਸਤੇ ਹੀ ਮਸ਼ਹੂਰ ਨੇ ਜੋ ਕਿ ਉਹਨਾਂ ਤੋਂ ਇਲਾਵਾ ਹੋਰ ਕੋਈ ਉਨੀ ਵਧੀਆ ਬਣਾ ਵੀ ਨਹੀਂ ਸਕਦਾ ਅਤੇ ਆਪਾਂ ਨੂੰ ਇਹ ਸਭ ਨੂੰ ਖਾਣੀ ਵੀ ਚੰਗੀ ਰੇ ਔਰ ਸਰਦੀਆਂ ਵਿੱਚ ਤਾਂ ਇਹ ਹੋਰ ਵੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਖਾਣੀ ਸਭ ਨੂੰ